ਸਤਿ ਸ਼੍ਰੀ ਅਕਾਲ ਮੇਰਾ ਨਾਮ ਵਾਸੂਦਾ ਹੈ ਅਤੇ ਮੈਂ ਪਠਾਨਕੋਟ ਜਿਲ੍ਹੇ ਦੀ ਰਹਿਣ ਵਾਲੀ ਹਾਂ ਅੱਜ ਮੈਂ ਤੁਹਾਨੂੰ ਡਿਜੀਟਲ ਟੈਕਨੋਲਜੀ ਹੁਨਰ ਬਾਰੇ ਕੁਛ ਮਤਲਬ ਦੱਸਣਾ ਚਾਹੁੰਦੀ ਹਾਂ ਜਿਵੇਂ ਕਿ ਹੁਣ ਆਪਾਂ ਗੱਲ ਕਰੀਏ ਟੈਕਨੋਲਜੀ ਦੀ ਅੱਜ ਕੱਲ੍ਹ ਤਾਂ ਹਰ ਜਗ੍ਹਾ ਮਤਲਬ ਕਿ ਹਰ ਇੱਕ ਜਗ੍ਹਾ ਐਜੂਕੇਸ਼ਨ ਹੋ ਗਿਆ ਸੈਂਟਰਸ ਹੋ ਗਏ ਮਤਲਬ ਔਲ ਮਤਲਬ ਔਲ ਜਗ੍ਹਾ 'ਤੇ ਇਸਦਾ ਉਪਯੋਗ ਕੀਆ ਜਾ ਰਿਹਾ ਹੈ ਜਿਵੇਂ ਕਿ ਹੁਣ ਆਪਾਂ ਸਕੂਲ ਵਿੱਚ ਜਾਂਦੇ ਹਾਂ ਸਕੂਲ ਵਿੱਚ ਇੱਦਾਂ ਸਾਨੂੰ ਚਿੱਤਰਾਂ ਦੇ ਬਾਰੇ ਨਹੀਂ ਸੀ ਪਤਾ ਲੱਗਦਾ ਪਰ ਜਦੋਂ ਦਾ ਹੁਣ ਟੈਕਨੋਲਜੀ ਦੇ ਰਾਹੀਂ ਹੁਣ ਕਲਾਸਾਂ ਵਿੱਚ ਪ੍ਰੋਜੈਕਟਰ ਲੱਗ ਗਏ ਹਨ ਪ੍ਰੋਜੈਕਟਰ ਲੱਗਣ ਨਾਲ ਇਹ ਹੋ ਗਿਆ ਹੈ ਕਿ ਬੱਚਿਆਂ ਨੂੰ ਹੋਰ ਵੀ ਮਤਲਬ ਕਾਫ਼ੀ ਸਹੀ ਤਰ੍ਹਾਂ ਉਨ੍ਹਾਂ ਨੂੰ ਚੀਜ਼ਾਂ ਬਾਰੇ ਦੱਸਿਆ ਜਾਂਦਾ ਹੈ ਜਿਵੇਂ ਕਿ ਮਤਲਬ ਕੋਈ ਪਿਚਰਸ ਹੈ ਹੁਣ ਕੋਈ ਵੀ ਚੀਜ਼ ਆ ਜਿਹੜੀ ਬੰਦਾ ਮਤਲਬ ਈ ਐ ਇੱਦਾਂ ਨਹੀਂ ਸਮਝਾ ਸਕਦਾ ਤਾਂ ਉਨ੍ਹਾਂ ਨੂੰ ਪਿਚਰ ਰਾਹੀਂ ਬੜੇ ਹੀ ਸਹੀ ਤਰ੍ਹਾਂ ਨਾਲ ਸਮਝਾਈ ਜਾ ਸਕਦੀ ਹੈ ਹੋਰ ਜਿਵੇਂ ਕਿ ਜਿੱਦਾਂ ਹੁਣ ਕਿਤਾਬਾਂ ਔਨਲਾਈਨ ਕੰਮ ਹੋ ਗਿਆ ਜਿੱਦਾਂ ਟੈਬਲੇਟ ਮਤਲਬ ਕਿ ਤੁਹਾਨੂੰ ਕਾਫ਼ੀ ਕੁਛ ਟੈਕਨੋਲਜੀ ਨੇ ਇੰਨੀ ਸਹੂਲਤ ਦੇ ਦਿੱਤੀ ਹੈ ਨਾ ਕਿ ਤੁਸੀਂ ਮਤਲਬ ਬਸ ਅੱਗੇ ਵਧੋ ਅਤੇ ਟੈਕਨੋਲਜੀ ਤੁਹਾਡੇ ਨਾਲ ਹੋ ਹਰੇਕ ਚੀਜ਼ ਜਿੱਦਾਂ ਟੈਕਨੋਲਜੀ ਦਾ ਮਤਲਬ ਯੂਜ ਲੱਭ ਜੇਗਾ ਹੁਣ ਤੁਸੀਂ ਕੁਛ ਵੀ ਜਿੱਦਾਂ ਕਰਨਾ ਹੋਵੇ ਜਿੱਦਾਂ ਕਿਸੇ ਨੂੰ ਮਤਲਬ ਮੈਸਿਜ ਵੀ ਕਰਨਾ ਹੋਵੇ ਤਾਂ ਮਤਲਬ ਫੋਨ ਹੁਣ ਸਾਡੇ ਕੋਲ ਸਮਾਟ ਫੋਨਸ ਹੈ ਆਪਾਂ ਕਿਸੇ ਨੂੰ ਮੈਸਿਜ ਕਰ ਸਕਦੇ ਹਾਂ ਆਪਾਂ ਦੂਰ ਬੈਠੇ ਕਿਸੇ ਨੂੰ ਟੈਕਨੋਲਜੀ ਦੇ ਥਰੂ ਹੀ ਫੋਨ ਤੋਂ ਆਪਾਂ ਕਿਸੇ ਨਾਲ ਗੱਲ ਕਰ ਸਕਦੇ ਹਾਂ ਫੇਸ ਟੂ ਫੇਸ ਪਰ ਪਹਿਲੇ ਟਾਈਮ 'ਤੇ ਇਹ ਨਹੀਂ ਸੀ ਟੈਕਨੋਲਜੀ ਨੇ ਸਾਨੂੰ ਮਤਲਬ ਕਾਫ਼ੀ ਕੁਛ ਸਾਡਾ ਸਹੀ ਕਰ ਦਿੱਤਾ ਹੈ ਮਤਲਬ ਇਨ ਸਾਰੀ ਜਗ੍ਹਾ ਹੀ ਟੈਕਨੋਲਜੀ ਹੀ ਹੋਰ ਬਸ ਮੈਂ ਇਹ ਹੀ ਕਹਿਣਾ ਚਾਹੁੰਦੀ ਕਿ ਟੈਕਨੋਲਜੀ ਦਾ ਮਤਲਬ ਸਾਡੇ ਜੀਵਨ 'ਚ ਬਹੁਤ ਹੀ ਜ਼ਿਆਦਾ ਪ੍ਰਭਾਵ ਪਏ ਦਾ ਹੋਰ ਧੰਨਵਾਦ